ਮੈਨੂੰ ਬਾਗਬਾਨੀ ਦਾ ਬਹੁਤ ਸ਼ੌਂਕ ਹੈ ਸਾਡੇ ਘਰ ਵਿੱਚ ਇੱਕ ਛੋਟਾ ਜਿਹਾ ਬਾਗ ਵੀ ਹੈ ਉਸ ਵਿੱਚ ਮੈਂ ਕਈ ਰੰਗ ਬਿਰੰਗੇ ਫੁੱਲ ਅਤੇ ਛੋਟੇ ਛੋਟੇ ਬੂਟੇ ਲਗਾਏ ਹਨ ਕਈ ਵਾਰੀ ਬਾਗਬਾਨੀ ਕਰਦਿਆਂ ਹੋਇਆਂ ਮੈਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਮੇਰੇ ਬਹੁਤ ਸੋਹਣੇ ਸੋਹਣੇ ਬੂਟਿਆਂ ਦੇ ਉੱਤੇ ਕੁਝ ਛੋਟੇ ਛੋਟੇ ਕੀੜੇ ਲੱਗ ਜਾਂਦੇ ਹਨ ਜਿਸ ਦੀ ਵਜ੍ਹਾ ਨਾਲ ਸਾਰਾ ਬੂਟਾ ਖਰਾਬ ਹੋ ਜਾਂਦਾ ਹੈ ਇਸ ਲਈ ਅਸੀਂ ਇੱਕ ਕੀਟਨਾਸ਼ਕ ਦਵਾਈ ਰੱਖੀ ਹੋਈ ਹੈ ਉਸ ਨੂੰ ਲਗਾ ਉਸ ਨੂੰ ਪੱਤਿਆਂ 'ਤੇ ਸਪਰੇਅ ਕਰਕੇ ਜਾਂ ਫਿਰ ਕਈ ਵਾਰੀ ਮਿੱਟੀ ਦੇ ਵਿੱਚ ਮਿਲਾ ਦਿੰਦੇ ਹਾਂ ਜਿਸ ਨਾਲ ਪੌਦੇ ਦੀ ਚੰਗੀ ਤਰ੍ਹਾਂ ਪੌਦੇ ਦੀ ਚੰਗੀ ਤਰ੍ਹਾਂ ਸਿੰਜਾਈ ਹੋ ਸਕੇ ਅਤੇ ਉਸਨੂੰ ਕੀੜੇ ਵੀ ਨਾ ਲੱਗਣ ਇਸੇ ਪ੍ਰਕਾਰ ਉਹਨਾਂ ਕੀੜਿਆਂ ਨੂੰ ਦੂਰ ਕਰ ਦਿੰਦੇ ਹਾਂ ਤਾਂ ਕਿ ਮੇਰਾ ਬਗੀਚਾ ਬਹੁਤ ਸੋਹਣਾ ਲੱਗਦਾ ਰਹੇ